ਮੈਂ ਅਕਸਰ ਤਾਂ ਟੂਰ 'ਤੇ ਨਹੀਂ ਜਾਂਦੀ ਪਰ ਜਦੋਂ ਵੀ ਜਾਂਦੀ ਹਾਂ ਤਾਂ ਕੋਸ਼ਿਸ਼ ਕਰਦੀ ਹਾਂ ਕਿ ਇਹ ਮੇਰੇ ਕੁਛ ਯਾਦਗਾਰੀ ਪਲ ਹੋਣ ਮੇਰੇ ਮਨ ਪਸੰਦੀਦਾ ਬਹੁਤ ਜ਼ਿਆਦਾ ਸਥਾਨ ਹਨ ਜੋ ਕਿ ਮੈਂ ਆਪਣੇ ਭਵਿੱਖ ਵਿੱਚ ਘੁੰਮਣਾ ਚਾਹੁੰਦੀ ਹਾਂ ਪਿਛਲੇ ਹੀ ਮਹੀਨੇ ਮੈਂ ਆਪਣੇ ਦੋਸਤਾਂ ਦੇ ਨਾਲ ਆਗਰੇ ਨੂੰ ਇੱਕ ਟੂਰ ਲਈ ਗਈ ਇਹ ਮੇਰਾ ਮਨ ਪਸੰਦੀਦਾ ਟੂਰ ਬਣ ਗਿਆ ਕਿਉਂਕਿ ਇੱਥੇ ਮੈਂ ਸੱਤ ਅਜੂਬਿਆਂ ਵਿੱਚੋਂ ਇੱਕ ਅਜੂਬਾ ਘੁੰਮਣ ਦਾ ਮੌਕਾ ਪਾਇਆ ਜੋ ਕਿ ਤਾਜ ਮਹਿਲ ਦੇ ਨਾਂ ਦੇ ਨਾਲ ਜਾਣਿਆ ਜਾਂਦਾ ਹੈ ਅਤੇ ਆਗਰੇ ਵਿੱਚ ਸਥਿਤ ਹੈ ਇਹ ਜਗ੍ਹਾ ਜਹਾਂਗੀਰ ਸ਼ਾਹ ਜਹਾਨ ਨੇ ਆਪਣੀ ਪਤਨੀ ਮੁਮਤਾਜ਼ ਦੀ ਯਾਦ ਵਿੱਚ ਬਣਾਇਆ ਸੀ ਅਤੇ ਮੈਂ ਅਤੇ ਮੇਰੇ ਦੋਸ ਦੋਸਤਾਂ ਨੇ ਇੱਥੇ ਬਹੁਤ ਜ਼ਿਆਦਾ ਫੋਟੋਜ਼ ਕਲਿੱਕ ਕਰੀਆਂ ਅਤੇ ਮੈਂ ਅਕਸਰ ਤਾਂ ਮੌਸਮ 'ਤੇ ਡਿ ਡਿਪੈਂਡ ਕਰਦਾ ਹੈ ਕਿ ਜਦੋਂ ਮੈਂ ਸਫ਼ਰ ਕਰਾਂਗੀ ਕਿਉਂਕਿ ਮੈਨੂੰ ਗਰਮੀ ਨਾਲੋਂ ਸਰਦੀ ਜ਼ਿਆਦਾ ਪਸੰਦ ਹੈ ਅਤੇ ਜਦੋਂ ਵੀ ਮੇਰੇ ਕੋਲ ਫਰੀ ਟਾਈਮ ਹੁੰਦਾ ਹੈ ਤਾਂ ਮੈਂ ਸਫ਼ਰ ਕਰਨਾ ਪਸੰਦ ਕਰਦੀ ਹਾਂ